ਸਤਿ ਸ਼੍ਰੀ ਅਕਾਲ ਵੀਰੇ ਮੈਂ ਕੁਲਵੰਤ ਬੋਲ ਰਿਹਾ ਜੀ ਮੈਂ ਤੁਹਾਡੀ ਕੈਬ ਬੁੱਕ ਕਰੀ ਤੀ ਜੀ ਅੱਧਾ ਘੰਟਾ ਹੋ ਗਿਆ ਜੀ ਮੈਨੂੰ ਉਡੀਕਦੇ ਨੂੰ ਹਾਲੇ ਤੱਕ ਕੈਬ ਨਹੀਂ ਪਹੁੰਚੀ ਮੈਂ ਕੈਬ ਦੇਰੀ ਹੋਣ ਦਾ ਕਾਰਨ ਜਾਣ ਸਕਦਾ ਮੈਨੂੰ ਕੈਬ ਇਸ ਲਈ ਬੁੱਕ ਕਰੀ ਤੀ ਵੀ ਮੈਂ ਜ਼ਰੂਰੀ ਮੀਟਿੰਗ ਵਿੱਚ ਜਾਣਾ ਸੀ ਤੁਹਾਡੀ ਕੈਬ ਨਹੀਂ ਇਸ ਨਾਲ ਤੋਂ ਮੈਂ ਚੰਗਾ ਕਿਸੇ ਬੱਸ ਚੜ੍ਹ ਕੇ ਚਲੇ ਜਾਂਦਾ ਤੁਸੀਂ ਮੈਨੂੰ ਅ ਹੁਣ ਐਨਾ ਕੁ ਦੱਸ ਸਕਦੇ ਹੋ ਵੀ ਕਿੰਨੇ ਕੁ ਟਾਈਮ ਵਿੱਚ ਪਹੁੰਚ ਸਕਦੇ ਹੋ ਕਿੰਨੇ ਕੁ ਟਾਈਮ 'ਚ ਨਹੀਂ ਨਹੀਂ ਫੇਰ ਮੈਂ ਬੱਸ ਚੜ੍ਹ ਕੇ ਜਾਵਾਂ